ਮੈਂ ਕੁਝ ਚਿਰ ਪਹਿਲਾਂ ਇੱਕ ਸੇਵਿੰਗ ਕਰੀਮ ਖਰੀਦੀ ਸੀਗੀ ਤਾਂ ਉਹਦਾ ਮੇਰਾ ਕੋਈ ਐਕਸਪੀਰੀਅਸ ਵਧੀਆ ਨਹੀਂ ਰਿਹਾ ਗਾ ਪਹਿਲੀ ਗੱਲ ਤਾਂ ਇਹ ਕਿ ਉਹ ਬਾਹਲੀ ਮਹਿੰਗੀ ਸੀਗੀ ਅਤੇ ਦੂਜੀ ਜਦੋਂ ਵੀ ਮੈਂ ਉਹਨੂੰ ਇਸਤੇਮਾਲ ਕਰਦੇ ਆ ਰਹਾਂ ਤਾਂ ਮੇਰੇ ਮੂੰਹ 'ਤੇ ਇੰਝ ਵੱਜਦੀ ਆ ਜਿਵੇਂ ਕਿਸੇ ਮੱਖੀ ਨੇ ਕੱਟ ਦਿੱਤਾ ਅਤੇ ਤੀਜੀ ਗੱਲ ਇਹ ਜਿਵੇਂ ਆਪਣੇ ਨੈਚੁਰਲ ਪ੍ਰੋਡਕਟ ਦੀ ਗੱਲ ਕਰਦੇ ਹਾਂ ਇਹਦੇ ਨਾਲ ਤਾਂ ਮੈਨੂੰ ਲੱਗਦਾ ਇਹ ਕੈਮੀਕਲ ਹੀ ਵੇਚ ਰਹੇ ਆਗੇ ਕੋਰਾ ਕੈਮੀਕਲ ਹੈਗਾ ਜੀ ਤੀਜਾ ਇਹ ਫੋਰਮ ਨਹੀਂ ਦਿੰਦੀ ਆ ਉਹ 'ਤੇ ਲਿਖਿਆ ਹੋਇਆ ਬਾਹਲੀ ਫੋਮ ਹੋਵੇਗੀ ਚਾਹੇ ਤੁਸੀਂ ਗਿੱਲੀ ਸ਼ੇਵ ਕਰ ਲਓ ਜਾਂ ਸੁੱਕੀ ਕਰ ਲਓ ਇਹ 'ਤੇ ਫੋਮ ਨਹੀਂ ਬਣਦੀ ਆ ਅਤੇ ਚੌਥੀ ਗੱਲ ਇਹ ਹੈ ਕਿ ਇਹ ਮੂੰਹ ਨੂੰ ਨਾ ਇੱਕ ਦਮ ਮੇਰੀ ਚਮੜੀ ਨੂੰ ਇਕਦਮ ਸੋਕਾ ਛੱਡ ਦਿੱਤੀ ਹੈ ਅਤੇ ਚੌਥੀ ਇਹਦੀ ਕੋਈ ਸੁਗੰਧ ਵੀ ਬਾਹਲੀ ਵਧੀਆ ਨਹੀਂ ਹੈਗੀ ਆ ਤਾਂ ਕੁੱਲ ਮਿਲਾ ਕੇ ਆਹ ਸ਼ੇਵਿੰਗ ਕਰੀਮ ਤਾਂ ਮੈਨੂੰ ਵਧੀਆ ਨਹੀਂ ਲੱਗੀ ਮੈਂ ਇਹ ਹੀ ਕਹੂੰਗਾ ਕਿ ਬਾਈ ਤੁਸੀਂ ਨਾ ਖਰੀਦਿਓ